ਹੈਲੋ ਵੈਦਵਾਨ ਟੈਕਸੀ ਸਟੈਂਡ ਹਾਂਜੀ ਮੈਂ ਤੁਹਾਡੇ ਕੋਲੋਂ ਕੈਬ ਬੁੱਕ ਕੀਤੀ ਸੀ ਏਅਰਪੋਰਟ ਜਾਣ ਵਾਸਤੇ ਏਅਰਪੋਰਟ ਉਹਨੇ ਕੀ ਸੀਗਾ ਉਹਦਾ ਰਸਤੇ 'ਚ ਖੜਦੀ ਸੀਗੀ ਖਰਾਬ ਹੋਗੀ ਖਰਾਬ ਹੋਣ ਕਾਰਨ ਮੇਰੀ ਗੱਡ ਮੇਰੀ ਫਲਾਈਟ ਵੀ ਮਿਸ ਹੋਗੀ ਜਿਸ ਕਰਕੇ ਮੇਰਾ ਬਹੁਤ ਜਿਆਦਾ ਨੁਕਸਾਨ ਹੋ ਗਿਆ ਕਿਉਂਕਿ ਮੈਂ ਅੱਗੇ ਕਿਸੀ ਮੀਟਿੰਗ 'ਚ ਜਾਣਾ ਸੀ ਮੀਟਿੰਗ ਨਾ ਜਾਣ ਕਾਰਨ ਮੇਰਾ ਕਾਫੀ ਨੁਕਸਾਨ ਹੋ ਗਿਆ ਇਸ ਕਰਕੇ ਹੁਣ ਕੀ ਹੱਲ ਕੀਤਾ ਜਾਵੇ ਇਹਦਾ ਮੈਂ ਨਾ ਪਹੁੰਚਿਆ ਮੇਰਾ ਲੱਖਾਂ ਨੁਕਸਾਨ ਹੋ ਗਿਆ ਤੁਸੀਂ ਤੁਹਾਡੇ ਤੁਸੀਂ ਕਿੱਦਾਂ ਦਾ ਡਰਾਈਵਰ ਮੇਰੇ ਕੋਲ ਭੇਜਿਆ ਸੀਗਾ ਜਿਹਨੂੰ ਗੱਡੀ ਚਲਾਉਣੀ ਨਹੀਂ ਆਉਂਦੀ ਸੀ ਗੇਅਰ ਫਸਾ ਕੇ ਬੈਠ ਗਿਆ ਇੱਥੇ ਰਸਤੇ 'ਚ ਉਦੋਂ ਗੇਅਰ ਨਿਕਲਣ ਤੋਂ ਏਅਰਪੋਰਟ ਗਏ ਸੀ ਤਾਂ ਫਲੈਟ ਮੇਰੀ ਚਲੇ ਗਈ ਸੀਗੀ ਜਿਸ ਕਰਕੇ ਮੇਰੇ ਪੈਸੇ ਤੁਸੀਂ ਤੁਹਾਨੂੰ ਵਾਪਸ ਕਰਨੇ ਪੈਣੇ ਹੈਗੇ ਐਨਾ ਨੁਕਸਾਨ ਹੋਣ ਕਰਕੇ ਉਹ ਤਾਂ ਤੁਸੀਂ ਭਰ ਨਹੀਂ ਸਕਦੇ ਮੇਰਾ ਟੈਕਸੀ ਦੇ ਪੈਸੇ ਤਾਂ ਵਾਪਿਸ ਕਰੋ ਜਿਸ ਕਰਕੇ ਮੈਂ ਅੱਗੇ ਤੋਂ ਤੁਹਾਡੀ ਟੈਕਸੀ ਤੁਹਾਡੀ ਵੈਦਵਾਨ ਟੈਕਸੀ ਸਟੈਂਡ ਦੇ ਨਾਮ ਵੀ ਮੈਂ ਬਦਨਾਮ ਕਰ ਦੇਣਾ ਹੁਣ ਤੁਹਾਡਾ ਇਸ ਕਰਕੇ ਤੁਹਾਡੇ ਕੋਲ ਕੋਈ ਗਾਹਕ ਹੀ ਨਾ ਆਵੇ